ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਮੁੰਡੇ ਤੁਰਲੇ ਵਾਲੀ ਪੱਗ ਨਾਲ ਕੁੜਤਾ ਚਾਦਰਾ ਪਾਉਂਦੇ ਹਨ ਅਤੇ ਅੱਖਾਂ ਵਿੱਚ ਕੱਜਲ ਪਾਨੇ ਜਿਸ ਨਾਲ ਉਹਨਾਂ ਦੀ ਆਣ ਬਾਨ ਸ਼ਾਨ ਹੁੰਦੀ ਹੈ ਅਤੇ ਪੰਜਾਬ ਦਾ ਭੰਗ ਪੰਜਾਬ ਦੇ ਵਿੱਚ ਭੰਗੜੇ ਨੂੰ ਇੱਕ ਬਹੁਤ ਵਧੀਆ ਲੋਕ ਨਾਚ ਮੰਨਿਆ ਜਾਂਦਾ ਹੈ ਜਿਸ ਨਾਲ ਹਰ ਜਗ੍ਹਾ 'ਤੇ ਬਹੁਤ ਫੇਮਸ ਹੈ ਦੂਰੋਂ ਦੂਰੋਂ ਬਾਹਰ ਦੇ ਵਿਦੇਸ਼ੀ ਲੋਕੀ ਆ ਕੇ ਦੇਖਦੇ ਹਨ ਵਿਦੇਸ਼ 'ਚ ਵੀ ਇਹ ਬਹੁਤ ਚੱਲਦਾ ਹੈ ਅਤੇ ਕੁੜੀਆਂ ਸਲਵਾਰ ਕਮੀਜ਼ ਪਾਉਂਦੀਆਂ ਹਨ ਗਹਿਣੇ ਸੱਗੀ ਫੁੱਲ ਅਤੇ ਜਦੋਂ ਉਹ ਭੰਗੜਾ ਪਾਉਂਦੇ ਹਨ ਅਤੇ ਪਤਾ ਲੱਗਦਾ ਹੈ ਪੰਜਾਬ ਦਾ ਬਹੁਤ ਵਧੀਆ ਭੰਗੜਾ ਮਤਲਬ ਅਕਰਸ਼ਤ ਲੱਗਦਾ ਵੇਖਣ 'ਚ ਹੀ ਉਹਨਾਂ ਦੇ ਡਰੈਸਿੰਗ ਜੋ ਕੱਪੜੇ ਪਾਉਂਦੇ ਹਨ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਅੱਜ ਵੀ ਸਾਡੇ ਪੰਜਾਬ ਵਿੱਚ ਸਾਡੇ ਲੋਕ ਨਾਚ ਨੂੰ ਇੰਨਾਂ ਪਹਿਨਾਵਾ ਦਿੱਤਾ ਜਾਂਦਾ ਮਹੱਤਵ ਦਿੱਤਾ ਜਾਂਦਾ ਅਤੇ ਜਿਸ ਨਾਲ ਲੋਕ ਬਾਹਰੋਂ ਦੀ ਲੋਕੀ ਆ ਕੇ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਕਿ ਪੰਜਾਬ ਦਾ ਇਹ ਸਭ ਤੋਂ ਵਧੀਆ ਅਤੇ ਬਹੁਤ ਮਨ ਬਹਿਲਾਨ ਬਲੀ ਚੀਜ਼ ਹੈ ਪੰਜਾਬ ਦੇ ਸੱਭਿਆਚਾਰ ਲਈ ਸਭ ਤੋਂ ਵਧੀਆ ਹੈ ਅਲਾ